ਅੱਜ ਕੱਲ੍ਹ ਦੇ ਕਈ ਲੋਕ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਉਹਨੂੰ ਉਹਨਾਂ ਨੂੰ ਪਾਠ ਪੜ੍ਹਾਉਣਾ ਸਿਖਾਉਂਦੇ ਆ ਉਹਨਾਂ ਨੂੰ ਗੁਰਬਾਣੀ ਪੜ੍ਹਨ ਨੂੰ ਕਹਿੰਦੇ ਆ ਸਿਖਾਉਂਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਇਹ ਅਤੇ ਉਸ ਚੀਜ਼ ਨਾਲ ਆਪਣੇ ਪੰਜਾਬ ਦੀ ਬੜੀ ਵਧੀਆ ਮਹੱਤਤਾ ਪੰਜਾਬੀ ਨੂੰ ਮਹੱਤਵਪੂਰਨ ਕਿਹਾ ਜਾਂਦਾ ਵਾ ਨਹੀਂ ਤਾਂ ਕਈ ਲੋਕ ਅੱਜ ਅੱਜ ਕੱਲ੍ਹ ਦੇ ਜ਼ਮਾਨੇ 'ਚ ਵੈਸੇ ਪੰਜਾਬੀ ਬੋਲਣਾ ਕੋਈ ਪਸੰਦ ਨਹੀਂ ਕਰਦਾ ਪੰਜਾਬ ਦੇ ਲੋਕ ਹੀ ਪੰਜਾਬੀ ਬੋਲਦੇ ਨਹੀਂ ਆ ਇੰਗਲਿਸ਼ ਬੋਲਦੇ ਆ ਹਿੰਦੀ ਬੋਲਦੇ ਇਹ ਦੋਨੋਂ ਚੀਜ਼ਾਂ ਜ਼ਿਆਦਾ ਪ੍ਰੈਫਰ ਕਰਦੇ ਆ ਕਿਉਂਕਿ ਅੱਜ ਕੱਲ੍ਹ ਜਗ੍ਹਾ ਜਗ੍ਹਾ 'ਤੇ ਇੰਗਲਿਸ਼ ਸਕੂਲ ਹੋ ਗਿਆ ਜਿ ਜਿਹਦੇ ਕਰਕੇ ਕਿ ਪੰਜਾਬੀ ਕਿਸੇ ਸਕੂਲ 'ਚ ਪੜ੍ਹਾਈ ਨਹੀਂ ਜਾਂਦੀ ਉਹਨਾਂ ਨੂੰ ਇੰਨਾ ਪਤਾ ਨਹੀਂ ਹੁੰਦਾ ਬੱਚਿਆਂ ਨੂੰ ਕਿ ਕਿਉਂ ਕੀ ਚੀਜ਼ ਕਿਸ ਤਰ੍ਹਾਂ ਕਰਨੀ ਆ ਪੰਜਾਬੀ ਆਪਣੀ ਮਾਤਰ ਭਾਸ਼ਾ ਹੈ ਜਿਹਨੂੰ ਕਿ ਕਦੇ ਅਸੀਂ ਭੁੱਲਦੇ ਨਹੀਂ ਆ ਜਿਹਨੂੰ ਕਦੀ ਭੁੱਲਣਾ ਵੀ ਨਹੀਂ ਚਾਹੀਦਾ ਕਿਉਂਕਿ ਸਾਡੀ ਮਾਤਰ ਭਾਸ਼ਾ ਹੁੰਦੀ ਆ ਅਤੇ ਅੱਜ ਕੱਲ੍ਹ ਦੇ ਲੋਕਾਂ ਨੂੰ ਸਗੋਂ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣਾ ਸਿਖਾਉਣਾ ਚਾਹੀਦਾ ਵਾ ਅੱਜ ਕੱਲ੍ਹ ਦੇ ਕਈ ਲੋਕ ਤਾਂ ਇੱਦਾਂ ਦੇ ਵੀ ਹੈਗੇ ਆ ਜਿਹੜੇ ਇਡੇ ਵੱਡੇ ਹੋ ਗੇ ਆ ਬਟ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਅੱਜ ਅ ਫੋਰਨ ਦੇ ਲੋਕ ਸਗੋਂ ਪੰਜਾਬੀ ਸਿੱਖਣਾ ਪਸੰਦ ਕਰਦੇ ਆ ਉਹ ਬੋਲਦੇ ਆ ਪੰਜਾਬੀ ਬਟ ਆਪਣੇ ਪੰਜਾਬ ਦੇ ਲੋਕ ਕਈ ਉੱਧਰ ਜਾ ਕੇ ਉੱਧਰ ਜਾਣ ਲਈ ਇੰਗਲਿਸ਼ ਸਿੱਖਣਦੇ ਆ ਤੋਂ ਸੋ ਸਾਨੂੰ ਵੱਧ ਤੋਂ ਵੱਧ ਪੰਜਾਬੀ ਸਿੱਖਣੀ ਚਾਹੀਦੀ ਆ ਅਤੇ ਬੋਲਣੀ ਚਾਹੀਦੀ ਆ ਆਪਣੇ ਬੱਚਿਆਂ ਨੂੰ ਸਿਖਾਉਣੀ ਚਾਹੀਦੀ ਹੈ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਜਦੋਂ ਵੀ ਗੱਲ ਕਰਨ ਪੰਜਾਬੀ 'ਚ ਗੱਲ ਕਰਨ ਹੁਣ ਦੇਖਦੇ ਹਾਂ ਅੰਮ੍ਰਿਤਸਰ ਦੇ ਵਿੱਚ ਵੀ ਆਪਾਂ ਜਾਂਦੇ ਹਾਂ ਅਤੇ ਉੱਥੇ ਵੀ ਬੱਚਿਆਂ ਨੂੰ ਹਿੰਦੀ ਬੋਲਣਾ ਜਾਂ ਇੰਗਲਿਸ਼ ਬੋਲਣਾ ਸਿਖਾਉਂਦੇ ਹੈ ਗਲਤੀ ਵੈਸੇ ਇਹ ਵੀ ਨਹੀਂ ਆ ਗਲਤੀ ਇਹ ਵੀ ਹੈ ਕਿ ਅੱਜ ਕੱਲ੍ਹ ਹਾਈ ਸਕੂਲ ਆ ਗਏ ਆ ਇੰਗਲਿਸ਼ ਸਕੂਲਸ ਆ ਗਏ ਉਹਨਾਂ ਵਿੱਚ ਇੰਗਲਿਸ਼ ਜ਼ਿਆਦਾ ਪ੍ਰੈਫਰ ਕਰਦੇ ਆ ਹਿੰਦੀ ਬੋਲਣਾ ਪ੍ਰੈਫਰ ਕਰਦੇ ਆ ਜਿਹਨਾਂ ਕਰਕੇ ਕਿ ਬੱਚੇ ਵੀ ਥੋੜ੍ਹੇ ਉੱਦਾਂ ਦੇ ਹੁੰਦੇ ਆ ਸੋ ਇਸ ਕਰਕੇ ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਧਿਆਨ ਦੇਣਾ ਚਾਹੀਦਾ ਕਿ ਆਪਣੇ ਬੱਚੇ ਇਹ ਪੰਜਾਬੀ ਬੋਲਣ ਕਿਉਂਕਿ ਆਪਣੀ ਇਹ ਮਾਤਰ ਭਾਸ਼ਾ ਆ